ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅਸੀਂ ਔਡਰ ਕਰਨੀ ਸੀ ਟੀ ਐਂਡ ਕੌਫੀ ਤੁਹਾਡੇ ਕੋਲੋਂ ਹਾਂਜੀ ਤੁਹਾਡੇ ਕੋਲ ਕਿਹੜੀ ਕਿਹੜੀ ਟੀ ਹੈ ਅਤੇ ਕੌਫੀ ਵੀ ਤੁਸੀਂ ਸਾਨੂੰ ਦੱਸੋ ਕਿ ਤੁਹਾਡੇ ਕੋਲ ਕਿਹੜੇ ਕਿਹੜੇ ਫਲੇਵਰਸ ਨੇ ਹਾਂਜੀ ਹਾਂਜੀ ਸਾਨੂੰ ਤੁਸੀਂ ਇੱਕ ਗ੍ਰੀਨ ਟੀ ਕਰ ਦਿਓ ਔਰ ਕੋਲਡ ਕੋਫੀ ਹਾਂਜੀ ਅਸੀਂ ਪੰਦਰਾਂ ਜਣੇ ਹਾਂ ਪੰਦਰਾਂ ਕੱਪ ਤੁਸੀਂ ਕਰ ਦੇਣੇ

ਹਾਂਜੀ ਤੁਸੀਂ ਸਾਡੇ ਔਡਰ 'ਤੇ ਭੇਜ ਦਿਓ ਬਰਾੜ ਕੈਫੇ ਹਾਂਜੀ

ਹਾਂਜੀ ਗਰੀਨ ਟੀ ਚਾਹੀਦੀ ਤੁਹਾਨੂੰ ਉਹਦੇ ਤੁਸੀਂ ਪੰਜ ਕੱਪ ਹਾਂਜੀ ਕੀ ਪ੍ਰਾਈਸ ਹੈ ਇਹਨਾਂ ਦਾ ਹਾਂਜੀ ਹਾਂਜੀ ਗਰੀਨ ਗਰੀਨ ਟੀ ਕੀ ਕੀ ਰੇਟ ਹੈ ਗਰੀਨ ਟੀ ਦਾ ਹਾਂਜੀ ਗਰੀਨ ਟੀ ਦਾ ਕੀ ਰੇਟ ਹੈ ਹਾਂਜੀ ਤੁਸੀਂ ਸਮਾਲ ਸੇਵ ਕਰ ਦੇਣਾ ਹਾਂਜੀ ਅਤੇ ਵਧੀਆ ਬਣਾਉਣਾ ਹਾਂਜੀ ਥੋੜ੍ਹਾ ਥੋੜ੍ਹਾ ਜਲਦੀ ਬਣਾ ਦੇ ਹਾਂਜੀ ਹਾਂਜੀ ਕੋਈ ਗੱਲ

ਹਾਂਜੀ ਤੁਸੀਂ ਨਾਲ ਦੋ ਸੈਂਡਵਿਚ ਕਰ ਦੇਣਾ ਹਾਂਜੀ ਹਾਂਜੀ ਨੋਰਮਲ ਨੋਰਮਲ ਬਣਾ ਦੇਣਾ ਹਾਂਜੀ ਪੀਜ਼ਾ ਕਰ ਦੇਣਾ ਤੁਸੀਂ ਬਰਾੜ ਕੈਫੇ 'ਤੇ ਭੇਜ ਦੇਣਾ ਇਹ ਸਭ ਸਮਾਨ ਹਾਂਜੀ ਅਤੇ ਥੋੜ੍ਹਾ ਜਿਹਾ ਜਲਦੀ ਤੋਂ ਜਲਦੀ ਭੇਜਣ ਦੀ ਕੋਸ਼ਿਸ਼ ਕਰਨੀ ਠੀਕ ਹੈ ਜੀ ਹਾਂਜੀ ਜੇ ਤੁਹਾਡੇ ਸਾਨੂੰ ਵਧੀਆ ਲੱਗਿਆ ਸਭ ਕੁਝ ਤਾਂ ਅਸੀਂ ਹੋਰ ਵੀ ਔਡਰ ਕਰਾਂਗੇ ਤੁਹਾਡੇ ਤੋਂ ਓਕੇ ਜੀ